ਬੁਣਾਈ ਅਤੇ ਹੋਰ ਜਿੰਮੇਵਾਰੀਆਂ ਨੂੰ ਰੁਚੀਆਂ ਨਾਲ ਸੰਤੁਲਿਤ ਕਰਨਾ ਪੈਂਦਾ ਹੈ ਕਿਉਂਕਿ ਘਰ ਦਾ ਕੰਮ ਕਰਕੇ ਇੱਧਰ ਉੱਧਰ ਘੁੰਮਣ ਨਾਲੋਂ ਜ਼ਿਆਦਾ ਬੈਟਰ ਹੈ ਆਪਣੇ ਕੰਮ ਵਿੱਚ ਰੁੱਝ ਜਾਓ ਇੱਕ ਤਾਂ ਕੁਛ ਸਿੱਖਣ ਨੂੰ ਮਿਲਦਾ ਹੈ ਔਰ ਦੂਸਰਾ ਟਾਈਮ ਸਾਡਾ ਚੰਗਾ ਪਾਸ ਹੋ ਜਾਂਦਾ ਹੈ ਇੱਧਰ ਉੱਧਰ ਚੁਗਲੀਆਂ ਕਰਨਾ ਇੱਧਰ ਉੱਧਰ ਘੁੰਮਣ ਨਾਲੋਂ ਬੈਟਰ ਹੈ ਆਪਣੇ ਕੰਮ ਵਿੱਚ ਰੁਚੀ ਰੱਖੋ ਇੱਕ ਤਾਂ ਚਾਰ ਪੈਸੇ ਆਉਂਦੇ ਹੈ ਘਰ ਦਾ ਸਰਕਲ ਵੀ ਠੀਕ ਚੱਲਦਾ ਰਹਿੰਦਾ ਦੂਸਰਾ ਸਾਨੂੰ ਇਹ ਕੁਛ ਕਰਨ ਨਾਲ ਅਪਣੀ ਬੁਣਾਈ ਦਾ ਕੰਮ ਹੈ ਸਿਲਾਈ ਦਾ ਕੰਮ ਕਰਦੀ ਹਾਂ ਕਾਫ਼ੀ ਕਸਟਮਰ ਹੈ ਉਹਨਾਂ ਨੂੰ ਉਹਨਾਂ ਨੂੰ ਮੇਰਾ ਕੰਮ ਹੱਥ ਦਾ ਕੰਮ ਕੀਤਾ ਪਸੰਦ ਵੀ ਕਾਫ਼ੀ ਆਉਂਦਾ ਹੈ ਕਿਉਂਕਿ ਉਹ ਕਹਿੰਦੇ ਹੈ ਕਿ ਤੁਹਾਡੇ ਹੱਥ 'ਚ ਸਫ਼ਾਈ ਬੜੀ ਹੈ ਔਰ ਇਸ ਤਰ੍ਹਾਂ ਘਰ ਦਾ ਕੰਮ ਕਰਕੇ ਜਦੋਂ ਵਿਹਲਾ ਟਾਈਮ ਹੁੰਦਾ ਹੈ ਟੀ ਵੀ ਦੇਖਣ ਨਾਲੋਂ ਬੈਟਰ ਆ ਆਪਣਾ ਕੰਮ ਕਰ ਲਓ ਘਰ ਦਾ ਕੰਮ ਕਰੀਦਾ ਔਰ ਰੁਚੀ ਅਨੁਸਾਰ ਆਪਣਾ ਕੰਮ ਵੀ ਕਰੀਦਾ ਔਰ ਦਿਨ ਦਾ ਦੋ ਤਿੰਨ ਸੌ ਰੁਪਿਆ ਕਮਾ ਵੀ ਲਈਦਾ ਔਰ ਇਸ ਤਰ੍ਹਾਂ ਹੀ ਬਸ ਟਾਈਮ ਕੱਢ ਲਈਦਾ ਇੱਧਰ ਉੱਧਰ ਨਹੀਂ ਜਾਈਦਾ ਅਤੇ ਬੁਣਾਈ ਦਾ ਸਿਲਾਈ ਦਾ ਕੰਮ ਕਰ ਲਈਦਾ ਔਰ ਆਡਰ ਵੀ ਪੂਰੇ ਟਾਈਮ 'ਤੇ ਭੁਗਤਾਈ ਦਾ ਕਿਸੇ ਨੂੰ ਇਹ ਨੀ ਸ਼ਿਕਾਇਤ ਦੇਈ ਦੀ ਕਿ ਅੱਜ ਚਾਹੀਦਾ ਤਾਂ ਕੱਲ੍ਹ ਦਿੱਤਾ ਹੈ ਜਾਂ ਇੱਦਾਂ ਕੀਤਾ ਹੈ ਔਰ ਉਹਨਾਂ ਨੂੰ ਮੇਰੇ ਹੱਥ ਦਾ ਕੰਮ ਬਹੁਤ ਪਸੰਦ ਹੈ ਬਾਕੀ ਹੋਰ ਵੀ ਕੰਮ ਕਰਨਾ ਚਾਹੁੰਦੀ ਹਾਂ ਪ੍ਰੋਜੈਕਟਾਂ 'ਤੇ ਵੀ ਮੈਂ ਕੰਮ ਕਰਨਾ ਚਾਹੁੰਦੀ ਹਾਂ ਲੇਕਿਨ ਉਹ ਦੇਖੋ ਜਦੋਂ ਕੰਮ ਆ ਜਾਂਦਾ ਕਰਕੇ ਦੇਈਦਾ ਟਾਈਮ 'ਤੇ ਇਸ ਤਰ੍ਹਾਂ ਮੇਰੇ ਇਸ ਤਰ੍ਹਾਂ ਕਸਟਮਰ ਕਾਫ਼ੀ ਵੱਧ ਗਏ ਹੈ ਔਰ ਮੇਰੇ ਕੰਮ ਦੀ ਕਾਫ਼ੀ ਪ੍ਰੇਜ਼ ਹੁੰਦੀ ਹੈ ਔਰ ਮੈਨੂੰ ਕਾਫ਼ੀ ਆਡਰ ਵੀ ਆ ਜਾਂਦੇ ਹੈ ਕੰਮ ਦੇ ਸਵੈਟਰਾਂ ਦੇ ਭਗਵਾਨ ਜੀ ਦੇ ਕੱਪੜਿਆਂ ਦੇ ਲੱਡੂ ਗੁਪਾਲ ਜੀ ਦੇ ਕੱਪੜਿਆਂ ਦੇ ਕਾਫ਼ੀ ਆਡਰ ਆਉਂਦੇ ਹੈ ਹੁਣ ਵੀ ਮੈਂ ਕੰਮ ਕਰ ਰਹੀ ਹਾਂ ਕ੍ਰਿਸ਼ਨ ਜੀ ਦੇ ਕੱਪੜੇ ਬਣਾ ਰਹੀ ਹਾਂ ਹਾਂਜੀ ਬਾਕੀ ਟਾਈਮ ਆਪਣਾ ਸਾਰਾ ਬਸ ਟਾਈਮ ਕੰਮ ਕਰਕੇ ਆਪਣਾ ਕੱਢੋ ਇੱਧਰ ਉੱਧਰ ਬੈਠਣ ਨਾਲੋਂ ਕੋਈ ਫ਼ਾਇਦਾ ਨਹੀਂ ਹੈ ਅਤੇ ਕੰਮ ਕਰਕੇ ਆਪਣਾ ਕੁਛ ਕਮਾਓ ਅਤੇ ਆਪਣੇ ਘਰ ਦਾ ਵੀ ਹੱਥ ਸਾਫ਼ ਰਹਿੰਦਾ ਅਤੇ ਹੱਥ ਖੁੱਲਾ ਰਹਿੰਦਾ ਹੈ